ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਸਾਰੇ ਠੀਕ ਆ ਘਰੇ ਬੱਚੇ ਬੁੱਚੇ ਜੀ ਅਸੀਂ ਯਾਦ ਕੀਤਾ ਅਸੀਂ ਤੁਹਾਡਾ ਨੰਬਰ ਲਿਆ ਸੀ ਅੱਜ ਇਥੋਂ ਇਥੋਂ ਲਿਆ ਸੀ ਅਸੀਂ ਗਵਾਂਢੋ ਅਸੀਂ ਨਾ ਇੱਥੇ ਕਿਰਾਏ 'ਤੇ ਆਏ ਸੀ ਹਾਂਜੀ ਹਾਂਜੀ ਅਤੇ ਅਸੀਂ ਅਸੀਂ ਥੋੜ੍ਹਾ ਨੰਬਰ ਲਿਆ ਸੀ ਅਤੇ ਸਾਨੂੰ ਕਿਸੇ ਨੇ ਦਿੱਤਾ ਸੀ ਅਤੇ ਅਸੀਂ ਇੱਕ ਤਾਂ ਸਬਜ਼ੀਆਂ ਬਾਰੇ ਤੁਹਾਨੂੰ ਪੁੱਛਣਾ ਸੀ ਵੀ ਇੱਥੇ ਤਾਜ਼ੀ ਸਬਜ਼ੀ ਕਿੱਥੋਂ ਮਿਲਦੀ ਆ ਹਾਂਜੀ ਹਾਂਜੀ ਨਵੇਂ ਆਏ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਉਹ ਨਾ ਅਸੀਂ ਸਬਜ਼ੀਆਂ ਬਾਰੇ ਪੁੱਛਣਾ ਸੀ ਵੀ ਵਧੀਆ ਸਬਜ਼ੀ ਵੀ ਜਿਵੇਂ ਇੱਕ ਤਾਂ ਆਮ ਬਈਏ ਜੇ ਲਾਈ ਬੈਠੇ ਹੁੰਦੇ ਆ ਉਹ ਨਹੀਂ ਇਹ ਵੀ ਆਪਣੀ ਆਪਣੀ ਜਿਮੀਦਾਰਾਂ ਵਾਲੀ ਸਬਜ਼ੀ ਹੋਵੇ ਕਿਸੇ ਨੇ ਘਰੇ ਲਾਈ ਹੋਵੇ ਜਾਂ ਮੰਡੀਆਂ 'ਚ ਵਧੀਆ ਸਬਜ਼ੀ ਕਿੱਤੇ ਆਉਂਦੀ ਹੋਵੇ ਅਤੇ ਉਹ ਸਾਨੂੰ ਤੁਸੀਂ ਦੱਸੋ ਅਸੀਂ ਉਥੋਂ ਨਵੀਂ ਸਬਜ਼ੀ ਲੈਣੀ ਹੁੰਦੀ ਆ

ਅੱਛਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਜਿ ਜਿਹੜੇ ਫਰੂਟ ਆ ਭਾਅ ਜੀ ਇਹ ਵੀ ਨਾਲ ਹੀ ਮਿਲਦੇ ਹੋਣਗੇ ਫਿਰ ਉੱਥੇ ਹੀ ਮਿਲ ਜਾਂਦੇ ਹੋਣਗੇ ਹਾਂਜੀ ਹਾਂਜੀ ਅਤੇ ਵੀ ਜਿਹੜੀਆਂ ਆਪਣੀਆਂ ਆਮ ਰੇੜੀਆਂ ਜਿਵੇਂ ਸੜਕ ਦੇ ਉੱਤੋਂ ਦੀ ਲੰਘਦੀਆਂ ਹੁੰਦੀਆਂ ਗਲੀਆਂ ਦੇ ਵਿੱਚ ਦੀ ਆਉਂਦੀਆਂ ਹੁੰਦੀਆਂ ਉਹ ਆਉਂਦੀਆਂ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਮੈਂ ਫਿਰ ਤੁਸੀਂ ਤਾਂ ਰਹਿਣ ਵਾਲੇ ਹੋ ਨਾ ਇੱਥੋਂ ਦੇ ਅਸੀਂ ਬਾਹਰ ਦੇ ਹਾਂਜੀ ਹਾਂਜੀ ਫਿਰ ਅਸੀਂ ਤਾਂ ਬਾਹਰ ਦੇ ਹਾਂ ਬਾਹਰ ਦੇ ਬੰਦੇ ਨੂੰ ਅਕਸਰ ਟਾਈਮ ਲੱਗਦਾ ਇੱਥੇ ਰਹਿਣ ਦਾ ਕਰਨ ਦਾ ਵਰਤਣ ਵਰਤਾਉਣ ਦਾ ਬੰਦਿਆਂ ਨਾਲ ਹੈ ਨਾ

ਹਾਂਜੀ

ਚਲੋ ਫਿਰ ਆਪਾਂ ਬਹਿਨੇ ਹਾਂ ਭਾਅ ਜੀ ਕਿਸੇ ਦਿਨ ਆਇਓ ਘਰੇ ਚਾਹ ਪਾਣੀ ਪੀਂਦੇ ਹਾਂ ਹਾਂਜੀ ਚਲੋ ਠੀਕ ਆ ਫਿਰ ਸਤਿ ਸ਼੍ਰੀ ਅਕਾਲ ਜੀ ਠੀਕ ਹੈ